ਪੰਜਾਬ ਵਿੱਚ ਨਿਊਜ਼ ਮੀਡੀਆ ਦੀ ਜੇ ਆਪਾਂ ਸਿਹਤ ਅਤੇ ਤੰਦਰੁਸਤੀ ਨਾਲ ਸੰਬੰਧਿਤ ਮੁੱਦਿਆਂ 'ਤੇ ਗੱਲ ਕਰੀਏ ਤਾਂ ਲੋਕਾਂ ਨੂੰ ਇਹ ਸਮੇਂ ਸਮੇਂ 'ਤੇ ਜਾਗਰਿਤ ਕਰਦਾ ਰਹਿੰਦਾ ਵੀ ਕਿਸ ਤਰ੍ਹਾਂ ਦਾ ਇਨਵਾਰਨਾਮੈਂਟ ਜਾਂ ਕਿਸ ਤਰ੍ਹਾਂ ਦੀ ਕੋਈ ਬਿਮਾਰੀ ਚੱਲੀ ਹੈ ਜਾਂ ਕੋਈ ਪਾਣੀ ਦਾ ਘਾਟ ਹੋ ਰਹੀ ਹੈ ਕੋਈ ਵੀ ਸਿਹਤ ਸੰਬੰਧੀ ਮੁੱਦੇ ਨੇ ਤਾਂ ਇਹ ਕਵਰ ਕਰਦੇ ਨੇ ਜਿਵੇਂ ਕਿ ਆਪਾਂ ਦੇਖਦੇ ਹਾਂ ਇਹ ਟੀ ਵੀ 'ਤੇ ਵੱਡੇ ਵੱਡੇ ਸਿਹਤ ਮਾਹਿਰਾਂ ਨੂੰ ਬੁਲਾ ਕੇ ਤਾਂ ਲੋਕਾਂ ਨੂੰ ਸਮਝਾਉਂਦੇ ਨੇ ਵੀ ਆਪਾਂ ਕਿਸ ਤਰ੍ਹਾਂ ਦੇ ਡਾਈਟ ਆਪਣਾ ਖਾਣਾ ਪੀਣਾ ਕਿਸ ਤਰ੍ਹਾਂ ਦਾ ਰੱਖਣਾ ਠੀਕ ਹੈ ਕਿਸ ਤਰ੍ਹਾਂ ਆਪਾਂ ਨੂੰ ਰੋਜ਼ ਡੇਲੀ ਕਸਰਤ ਕਰਨੀ ਚਾਹੀਦੀ ਆ ਜਾਂ ਆਪਾਂ ਨੂੰ ਕਿਸ ਤਰ੍ਹਾਂ ਦੇ ਖਾਣੇ ਨਹੀਂ ਖਾਣੇ ਚਾਹੀਦੇ ਜਾਂ ਆਪਾਂ ਅਲੱਗ ਅਲੱਗ ਡਾਕਟਰਾਂ ਨੂੰ ਜਿਵੇਂ ਦੇਖ ਲਈਏ ਅੱਖਾਂ ਦੀ ਬਿਮਾਰੀ ਤੋਂ ਕਿਵੇਂ ਬਚਿਆ ਜਾ ਸਕਦਾ ਜਾਂ ਕਿਸ ਤਰ੍ਹਾਂ ਦਾ ਹੈਗਾ ਇਹ ਸਾਰਾ ਹੀ ਨਿਊਜ਼ ਮੀਡੀਆ ਖ਼ਬਰਾਂ ਦੇ ਵਿੱਚ ਲੋਕਾਂ ਨੂੰ ਸਲਾਹ ਦਵਾਉਂਦਾ ਵੱਡੇ ਵੱਡੇ ਮਾਹਿਰਾਂ ਤੋਂ ਜਿਵੇਂ ਕਿ ਕੋਈ ਅੱਖਾਂ ਦਾ ਕੈਂਪ ਲੱਗ ਰਿਹਾ ਕਿਤੇ ਕਿਤੇ ਕੋਈ ਖੂਨ ਟੈਸਟ ਦਾ ਕੈਂਪ ਲੱਗ ਰਿਹਾ ਫਰੀ ਚੈੱਕ ਅਪ ਦਾ ਕੈਂਪ ਲੱਗ ਰਿਹਾ ਉਹ ਵੀ ਨਿਊਜ਼ ਮੀਡੀਆ ਰਾਹੀ ਦੱਸਿਆ ਜਾਂਦਾ ਬਾਕੀ ਜਿਵੇਂ ਕੋਈ ਅਜੋਕੀਆਂ ਸਰਕਾਰਾਂ ਨੇ ਸਰਕਾਰਾਂ ਕੋਈ ਜਿਵੇਂ ਕੋਈ ਵੀ ਸਿਹਤ ਸਬੰਧੀ ਸਕੀਮਾਂ ਚਲਾਉਂਦੀਆਂ ਨੇ ਜਿਵੇਂ ਪੰਜਾਬ ਦੇ ਵਿੱਚ ਭਾਰਤ ਸਰਕਾਰ ਦਾ ਚੱਲ ਰਿਹਾ ਪੰਜ ਲੱਖ ਤੱਕ ਦਾ ਇਲਾਜ ਫਰੀ ਹੈ ਲੋਕਾਂ ਨੂੰ ਉਸ ਤਰ੍ਹਾਂ ਦੇ ਸਿਹਤ ਜਾਂ ਪੰਜਾਬ ਸਰਕਾਰ ਦੀ ਕੋਈ ਸਿਹਤ ਸੰਬੰਧੀ ਸਹੂਲਤਾਂ ਨੇ ਕੋਈ ਵੀ ਚੱਲੀਆਂ ਨੇ ਤਾਂ ਲੋਕਾਂ ਨੂੰ ਵਾਰ ਵਾਰ ਜਾਗਰੂਕ ਕਰਦਾ ਰਹਿੰਦਾ ਇਸ ਬਾਰੇ ਤਾਂ ਆਪਾਂ ਕਹਿ ਸਕਦੇ ਹਾਂ ਪੰਜਾਬ ਵਿੱਚ ਨਿਊਜ਼ ਮੀਡੀਆ ਦੀ ਸਿਹਤ ਤੰਦਰੁਸਤੀ ਸਬੰਧੀ ਵਧੀਆ ਮੁੱਦਿਆਂ ਨੂੰ ਕਵਰ ਕਰ ਰਿਹਾ